ਹਾਲ ਦੇ ਸਾਲਾਂ ਵਿੱਚ ਸੈਰ ਸਪਾਟਾ ਘਟਿਆ ਨਹੀਂ ਹੈ ਬਲਕਿ ਵਧਿਆ ਹੈ ਅੱਜ ਦੇ ਅਜੋਕੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਸੈਰ ਸਪਾਟਾ ਇੱਕ ਟਰੈਂਡ ਰੁਝਾਨ ਬਣ ਗਿਆ ਹੈ ਜਿਵੇਂ ਹੀ ਲੋਕ ਆਪਣੇ ਹਰ ਰੋਜ਼ ਦੇ ਦੈਨਿਕ ਕੰਮਾਂ ਤੋਂ ਖਾਲੀ ਹੁੰਦੇ ਹਨ ਉਹਨਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਸੈਰ ਸਪਾਟੇ ਲਈ ਜਾਣਾ ਪਸੰਦ ਕਰਦੇ ਹਨ ਫਿਰ ਚਾਹੇ ਉਹ ਕੋਈ ਇੱਕ ਵਿਦਿਆਰਥੀ ਹੋਵੇ ਜਾਂ ਫਿਰ ਕੋਈ ਨੌਕਰੀ ਪੇਸ਼ਾ ਵਰਗ ਦਾ ਵਿਅਕਤੀ ਹੋਵੇ ਜਾਂ ਫਿਰ ਇੱਕ ਪਰਿਵਾਰਿਕ ਮਾਹੌਲ ਨੂੰ ਬਿਲੋਂਗ ਕਰਨ ਵਾਲਾ ਇੱਕ ਵਿਅਕਤੀ ਹੋਵੇ ਸਾਰੇ ਵਿਅਕਤੀ ਟੂਰਿਸਟ ਪਲੇਸਾਂ 'ਤੇ ਜਾਣਾ ਪਸੰਦ ਕਰਦੇ ਹਨ ਆਂ ਜਿਵੇਂ ਜਿਵੇਂ ਕਿਸੇ ਨੂੰ ਸਮਾਂ ਮਿਲਦਾ ਹੈ ਤਾਂ ਉਹ ਜਾਂਦੇ ਹਨ ਇੱਕ ਵਿਦਿਆਰਥੀ ਆਪਣੇ ਹਰ ਰੋਜ਼ ਦੀ ਪੜ੍ਹਾਈ ਜਿਸ ਤੋਂ ਕਈ ਵਾਰ ਉਹ ਤੰਗ ਵੀ ਹੋ ਜਾਂਦਾ ਹੈ ਤਾਂ ਆਪਣੇ ਮਨ ਨੂੰ ਦਿਮਾਗ ਨੂੰ ਤਰੋ ਤਾਜ਼ਾ ਕਰਨ ਦੇ ਲਈ ਟੂਰ 'ਤੇ ਜਾਂਦਾ ਹੈ ਜਿਵੇਂ ਕਿ ਕਿਸੇ ਵਿਦਿਆਰਥੀ ਨੂੰ ਗਰਮੀ ਦੀਆਂ ਸਰਦੀ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਵੀ ਉਹ ਆਪਣੇ ਉਸ ਸਮੇ ਨੂੰ ਇੱਕ ਟੂਰ 'ਤੇ ਜਾਣ ਲਈ ਵਰਤ ਲੈਂਦਾ ਹੈ ਇਸ ਤਰ੍ਹਾਂ ਹੀ ਨੌਕਰੀ ਪੇਸ਼ਾ ਵਿਅਕਤੀ ਜਦੋਂ ਹੀ ਆਪਣੀਆਂ ਨੌਕਰੀਆਂ ਤੋਂ ਖਾਲੀ ਹੁੰਦੇ ਹਨ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਟੂਰਿਸਟ ਪਲੇਸਾਂ 'ਤੇ ਜਾਣਾ ਪਸੰਦ ਕਰਦੇ ਹਨ ਔਰ ਪਰਿਵਾਰਿਕ ਮਾਹੌਲ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਲੋਕ ਟੂਰਾਂ 'ਤੇ ਜਾਣਾ ਬਹੁਤ ਪਸੰਦ ਕਰਦੇ ਹਨ ਸਿਰਫ਼ ਦੇਸ਼ ਦੇ ਵਿੱਚ ਹੀ ਨਹੀਂ ਲੋਕ ਵਿਦੇਸ਼ਾਂ ਦੇ ਵਿੱਚ ਵੀ ਟੂਰਾਂ 'ਤੇ ਜਾਣਾ ਪਸੰਦ ਕਰਦੇ ਹਨ ਜਿਵੇਂ ਕਨੇਡਾ ਅਮਰੀਕਾ ਦਾ ਲੋਕ ਟੂਰਿਸਟ ਵੀਜ਼ਾ ਲਗਵਾ ਕੇ ਜਾਂਦੇ ਹਨ ਟੂਰਿਸਟ ਪਲੇਸਾਂ 'ਤੇ ਜਾਣ ਕਾਰਨ ਭਾਈਚਾਰਾ ਘਟਿਆ ਨਹੀਂ ਵਧਿਆ ਹੈ ਕਿਉਂਕਿ ਮੰਨ ਕੇ ਚੱਲੋ ਜੇ ਕਿਸੇ ਵਿਅਕਤੀ ਦਾ ਕੋਈ ਮਿੱਤਰ ਸਬੰਧੀ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿ ਰਹ ਰਿਹਾ ਹੈ ਤਾਂ ਉਹ ਟੂਰਿਸਟ ਵੀਜ਼ਾ ਲਗਵਾ ਕੇ ਉਸਨੂੰ ਮਿਲਣ ਗਿਆ ਹੈ ਤਾਂ ਉਸਦੇ ਵਿੱਚ ਇੱਕ ਸਾਂਝ ਪੈਦਾ ਹੋਵੇਗੀ ਨੇੜਤਾ ਵਧੇਗੀ ਸੰਪਰਕ ਵਧਣਗੇ ਅਤੇ ਇਸ ਤਰ੍ਹਾਂ ਹੀ ਜੇਕਰ ਅਸੀਂ ਕਿਸੇ ਹੋਰ ਅਣਜਾਣ ਜਗ੍ਹਾਂ 'ਤੇ ਵੀ ਟੂਰਿਸਟ ਪਲੇਸ ਲਈ ਜਾਂਦੇ ਹਾਂ ਤਾਂ ਉੱਥੇ ਵੀ ਜਦੋਂ ਅਸੀਂ ਕੁਝ ਲੋਕਾਂ ਨੂੰ ਮਿਲਦੇ ਹਾਂ ਉਹਨਾਂ ਦੇ ਵਿੱਚ ਅਸੀਂ ਵਿਚਰਦੇ ਹਾਂ ਤਾਂ ਸਾਡਾ ਇੱਕ ਭਾਈਚਾਰਾ ਕਾਇਮ ਹੁੰਦਾ ਇੱਕ ਸਾਡੀ ਆਪਸੀ ਸਾਂਝ ਜਿਹੜੀ ਹੈ ਕਾਇਮ ਹੁੰਦੀ ਹੈ ਤਾਂ ਟੂਰਿਸਟ ਪਲੇਸਾਂ ਨੇ ਟੂਰਾਂ 'ਤੇ ਜਾਣ ਕਾਰਣ ਕੋਈ ਭਾਈਚਾਰਾ ਘਟਿਆ ਨਹੀਂ ਹੈ ਭਾਈਚਾਰੇ ਨੂੰ ਵਧੇਰੇ ਅੱਗੇ ਲੈ ਕੇ ਗਏ ਹਨ ਟੂਰ